ਹੈਲੋ ਹਾਂਜੀ ਬੋਲੋ ਜੀ ਹਾਂਜੀ ਬੋਲੋ ਮੈਡਮ ਹਾਂਜੀ ਹਾਂਜੀ ਜੀ ਸਾਡੇ ਕੋਲ ਹਰ ਤਰ੍ਹਾਂ ਦਾ ਫਲੇਵਰ ਹੈ ਜੀ ਸਾਡੇ ਕੋਲ ਜੀ ਦੇਖੋ ਚਾਟੀ ਵਾਲੀ ਲੱਸੀ ਵੀ ਹੈ ਸਾਡੇ ਕੋਲ ਜੀਰਾ ਲੱਸੀ ਹੈ ਸਾਡੇ ਕੋਲ ਕਈ ਲੋਕ ਲਾਲ ਮਿਰਚ ਵਾਲੀ ਪਸੰਦ ਕਰਦੇ ਉਹ ਵੀ ਅਸੀਂ ਤਿਆਰ ਕਰ ਦਿੰਦੇ ਹਾਂ ਸਾਡੇ ਕੋਲ ਮਿਕਸੀ ਨਾਲ ਗ੍ਰਾਈਂਡ ਕੀਤੀ ਲੱਸੀ ਵੀ ਹੈ ਸਾਡੇ ਕੋਲ ਮਿੱਠੀ ਲੱਸੀ ਵੀ ਹੈ ਹੁਣ ਜਿਵੇਂ ਕਈ ਲੋਕ ਗੁੜ ਵ ਗੁੜ ਵਾਲੀ ਲੱਸੀ ਵੀ ਪਸੰਦ ਕਰਦੇ ਹੈ ਉਹ ਵੀ ਹੈ ਚੀਨੀ ਵਾਲੀ ਲੱਸੀ ਵੀ ਹੈ ਸਾਡੇ ਕੋਲ ਸੰਘਣੀ ਲੱਸੀ ਵੀ ਹੈ ਔਰ ਪਤਲੀ ਲੱਸੀ ਵੀ ਹੈ ਅਗਰ ਕਿਸੇ ਨੇ ਜਿਵੇਂ ਮੱਖਣ ਵਾਲੀ ਲੱਸੀ ਲੈਣੀ ਹੋਵੇ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਸਾਡੇ ਕੋਲ ਪੁਦੀਨੇ ਵਾਲੀ ਲੱਸੀ ਵੀ ਹੈ ਹਾਂਜੀ ਤਾਂ ਸਾਡੇ ਕੋਲ ਹਾਂਜੀ ਹਾਂਜੀ ਬਿਲਕੁਲ ਇਹ ਸਾਡੇ ਕੋਲ ਡੇਲੀ ਇੱਥੇ ਦੁੱਧ ਆਉਂਦਾ ਉਹਦੇ 'ਚੋਂ ਅਸੀਂ ਖ਼ੁਦ ਮੱਖਣ ਨਿਕਾਲਦੇ ਹਾਂ ਔਰ ਉਸਦੇ ਵਿੱਚੋਂ ਹੀ ਅਸੀਂ ਲੱਸੀ ਤਿਆਰ ਕਰਦੇ ਹਾਂ ਬਿਲਕੁਲ ਪਿਓਰ ਮਿਲੇਗੀ ਹੰਡਰਡ ਪਰਸੈਂਟ ਸੌ ਪਰਸੈਂਟ ਲੱਸੀ ਤੁਹਾਨੂੰ ਪਿਓਰ ਮਿਲੇਗੀ ਔਰ ਲੱਸੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੋਏਗੀ ਜਿਸ ਤਰ੍ਹਾਂ ਦੀ ਤੁਸੀਂ ਕਹੋਗੇ ਤੁਹਾਨੂੰ ਉਸ ਤਰ੍ਹਾਂ ਦੀ ਹੀ ਲੱਸੀ ਮਿਲੇਗੀ ਔਰ ਕਈ ਲੋਕ ਜ਼ਿਆਦਾ ਖੱਟੀ ਪੀਣੀ ਪਸੰਦ ਕਰਦੇ ਹੈ ਸਾਡੇ ਕੋਲ ਜ਼ਿਆਦਾ ਖੱਟੀ ਲੱਸੀ ਵੀ ਹੈ ਕਈ ਲੋਕ ਨੋਰਮਲ ਜਿਹੀ ਪੀਂਦੇ ਹੈ ਉਸ ਤਰ੍ਹਾਂ ਦੀ ਲੱਸੀ ਵੀ ਹੈ ਹਾਂਜੀ ਇਕੱਲੇ ਨਮਕ ਵਾਲ ਹਾਂਜ ਇਕੱਲੇ ਨਮਕ ਵਾਲੀ ਲੱਸੀ ਵੀ ਹੈ ਜਿਵੇਂ ਕੱਲਾ ਵਾਈਟ ਨਮਕ ਚਿੱਟਾ ਨਮਕ ਵਾਲੀ ਹੈ ਉਹ ਲੱਸੀ ਵੀ ਸਾਡੇ ਕੋਲ ਹੈ ਵੀ ਅਸੀਂ ਕਾਲੀ ਮਿਰਚ ਨਹੀਂ ਐਡ ਕਰਦੇ ਜਾਂ ਜੀਰਾ ਨਹੀਂ ਐਡ ਕਰਦੇ ਅਸੀਂ ਪਰਸਨ ਦੀ ਜਿਹੜੀ ਡਿਮਾਂਡ ਹੈ ਉਹ ਦੇ ਹਿਸਾਬ ਨਾਲ ਅਸੀਂ ਹਰ ਤਰ੍ਹਾਂ ਦੀ ਲੱਸੀ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਹਾਂਜੀ ਜੀ ਰੇਟ ਇਹਦੇ ਜਿਵੇਂ ਤੁਸੀਂ ਕਹਿ ਲਓ ਜਿਵੇਂ ਮੱਖਣ ਵਾਲੀ ਲੱਸੀ ਹੈ ਉਹਦਾ ਰੇਟ ਤਾਂ ਤੁਹਾਨੂੰ ਪਤਾ ਹੀ ਹੈ ਜ਼ਿਆਦਾ ਹੋਉਗਾ ਕਿਉਂਕਿ ਉਹ ਦੇ ਵਿੱਚ ਮੱਖਣ ਹੈ ਤਾਂ ਉਹਦੇ ਰੇਟ ਸਭ ਤੋਂ ਜ਼ਿਆਦਾ ਹਾਈ ਰੇਟ ਨੇ ਔਰ ਉਹਤੋਂ ਬਾਅਦ ਸਾਡੇ ਕੋਲ ਜਿਹੜੀ ਚਾਟੀ ਵਾਲੀ ਲੱਸੀ ਹੈ ਉਸ ਦੇ ਵੀ ਰੇਟ ਉਸ ਤੋਂ ਥੋੜ੍ਹੇ ਘੱਟ ਹੈ ਅਤੇ ਬਾਕੀ ਜਿਵੇਂ ਪੁਦੀਨੇ ਵਾਲੀ ਲੱਸੀ ਹੈ ਉਹਦੇ ਵੀ ਰੇਟ ਥੋੜ੍ਹੇ ਹੋਰ ਘੱਟ ਹੈ ਔਰ ਜਿਹੜੇ ਕਹਿ ਲਓ ਨਮਕ ਪੁਦੀਨੇ ਵਾਲੀ 'ਚ ਅਸੀਂ ਨਾ ਜਿਵੇਂ ਕਾਲਾ ਨਮਕ ਐਡ ਕਰਦੇ ਹਾਂ ਜੀਰਾ ਵੀ ਐਡ ਕਰਦੇ ਹਾਂ ਅਗਰ ਕਿਸੇ ਨੇ ਵਿੱਚ ਜੀਰਾ ਨਹੀਂ ਵੀ ਪੁਆਉਣਾ ਤਾਂ ਵੀ ਚੱਲ ਜਾਂਦਾ ਹੈ ਤਾਂ ਨਮਕ ਐਡ ਕਰਦੇ ਹਾਂ ਵਿੱਚ ਅਸੀਂ ਦੇਸੀ ਨਮਕ ਯੂਜ ਕਰਦੇ ਹਾਂ ਔਰ ਅਸੀਂ ਉਹਦੀ ਪੁਦੀਨੇ ਦੀ ਚੱਟਣੀ ਕੁੱਟ ਕੇ ਵਿੱਚ ਪਾਉਂਦੇ ਹਾਂ ਕਈ ਲੋਕ ਸਾਡੇ ਤੋਂ ਪਿਆਜ਼ ਵੀ ਪੁਆ ਲੈਂਦੇ ਹੈ ਲਾਲ ਮਿਰਚਾਂ ਵੀ ਕੁੱਟ ਪੁਆਉਂਦੇ ਹੈ ਅਸੀਂ ਉਹ ਵੀ ਉਹ ਵਾਲੀ ਲੱਸੀ ਵੀ ਤਿਆਰ ਕਰ ਦਿੰਦੇ ਹਾਂ ਅਗਰ ਕਿਸੇ ਨੇ ਲਾਲ ਮਿਰਚਾਂ ਕੁੱਟ ਕੇ ਪੁਆਉਣੀ ਹੋਵੇ ਉਹ ਲੱਸੀ ਵੀ ਤਿਆਰ ਹਾਂਜੀ ਬਾਕੀ ਜੀ ਦੇਖੋ ਬਜ਼ਾਰ ਨਾਲੋਂ ਸਾਡੇ ਰੇਟ ਜਿਹੜੇ ਹੈ ਉਹ ਘੱਟ ਹੀ ਮਿਲਣਗੇ ਤੁਹਾਨੂੰ ਤੁਸੀਂ ਇੱਕ ਵਾਰੀ ਪੀ ਕੇ ਜ਼ਰੂਰ ਦੇਖੋ ਔਰ ਤੁਸੀਂ ਇੱਕ ਵਾਰੀ ਪੀਓਗੇ ਤੁਸੀਂ ਵਾਰ ਵਾਰ ਯਾਦ ਕਰੋਗੇ ਔਰ ਵਾਰ ਵਾਰ ਆਉਂਗੇ ਸਾਡੇ ਕੋਲ ਠੀਕ ਹੈ ਜੀ ਹਾਂਜੀ ਠੀਕ ਹੈ ਜੀ